ਮੈਨੂੰ ਪੜ੍ਹਨ ਦਾ ਕਾਫੀ ਸ਼ੌਂਕ ਹੈ ਕਿਤਾਬਾਂ ਤੋਂ ਇਲਾਵਾ ਮੈਂ ਰੋਜ਼ਾਨਾ ਅਖ਼ਬਾਰ ਅਤੇ ਮੈਗਜ਼ੀਨ ਵੀ ਪੜ੍ਹਦਾ ਹਾਂ ਜਿਸ ਦੇ ਵਿੱਚ ਕਾਫੀ ਜ਼ਿਆਦਾ ਜਾਣਕਾਰੀ ਮਿਲਦੀ ਹੈ ਮੇਰੇ ਪਾਸ ਰੋਜ਼ਾਨਾ ਪੰਜਾਬੀ ਦੀ ਅਖ਼ਬਾਰ ਜਗਬਾਣੀ ਆ ਰਹੀ ਹੈ ਜਿਸ ਦੇ ਵਿੱਚ ਸਪੋਰਟਸ ਬਾਰੇ ਅਤੇ ਦੇਸ਼ ਵਿੱਚ ਹੋ ਰਹੀਆਂ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਬਾਰੇ ਇਨਵਾਇਰਮੈਂਟ ਬਾਰੇ ਸਾਰਾ ਪਤਾ ਚੱਲ ਜਾਂਦਾ ਹੈ ਅਤੇ ਆਪਣੇ ਆਸ ਪਾਸ ਅਤੇ ਦੂਰ ਦੁਰਾਡੇ ਦੇਸ਼ਾਂ ਦੀ ਜਾਣਕਾਰੀ ਉਸ ਦੇ ਵਿੱਚ ਪੂਰੀ ਪੂਰੀ ਮਿਲ ਜਾਂਦੀ ਹੈ ਜਿਸ ਦੇ ਨਾਲ ਰੋਜ਼ਾਨਾ ਕਾਫੀ ਗਿਆਨ ਹਾਸਿਲ ਹੁੰਦਾ ਹੈ ਅਤੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕੀਤੀਆਂ ਹੋਈਆਂ ਗੱਲਾਂ ਜੋ ਹੈ ਉਹ ਸਾਰੀਆਂ ਸਾਹਮਣੇ ਆ ਜਾਂਦੀਆਂ ਨੇ ਜਿਸ ਤੋਂ ਅੱਗੇ ਜ਼ਿੰਦਗੀ ਨੂੰ ਹੋਰ ਸੁਖਾਲਾ ਕਰਨ ਲਈ ਕੁਝ ਨਵੀਂ ਟੈਕਨੀਕਸ ਦਾ ਵੀ ਪਤਾ ਚੱਲਦਾ ਹੈ ਜਿਸ ਦੇ ਨਾਲ ਟਾਈਮ ਪਾਸ ਵੀ ਹੋ ਜਾਂਦਾ ਹੈ ਅਤੇ ਨੌਲਿਜ ਵੀ ਮਿਲ ਜਾਂਦੀ ਹੈ ਇਸ ਤਰ੍ਹਾਂ ਸਾਰਾ ਦਿਨ ਆਰਾਮ ਨਾਲ ਘਰ ਬੈਠ ਕੇ ਟਾਈਮ ਸਪੈਂਡ ਕੀਤਾ ਜਾ ਸਕਦਾ ਹੈ